ਸਪੀਕ ਆਉਟ ਦ ਫੋਲੋਇੰਗ ਨੇਮਸ ਓਫ ਵਹੀਕਲ ਮਿਟਸੂਬੀਸ਼ੀ ਗੈਲਣਟ ਏਫ ਟੀ ਓ ਟੋਇਟਾ ਅਰਬਨ ਕਰੁਜ਼ਰ ਬੁਲੇਟ ਮਾਰੂਤੀ ਸੁਜ਼ੂਕੀ ਥਾਰ ਐਂਡ ਸਵਿਫਟ ਆਈ ਟੈਨ ਆਈ ਟਵੈਂਟੀ